ਸਰਕਾਰੀ ਭਾਸ਼ਾਵਾਂ ਸਾਡੇ ਸਰਕਾਰੀ ਕੰਮਾਂ ਵਿੱਚ ਜ਼ਿਆਦਾਤਰ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਰਤੀ ਜਾ ਹੁੰਦੀ ਹੈ ਵਰਤੋਂ ਹੁੰਦੀ ਹੈ ਪੰਜਾਬ ਪੰਜਾਬੀ ਭਾਸ਼ਾ ਸਾਡੇ ਪੰਜਾਬ ਵਿੱਚ ਵਰਤੀ ਜਾਂਦੀ ਹੈ ਮਾਤਰ ਭਾਸ਼ਾ ਉਰਦੂ ਹਰਿਆਣਵੀ ਤਾਮਿਲ ਮੇਰਾਠੀ ਤਾਮਿਨ ਮਾਲਵਾੜੀ ਬਿਹਾਰੀ ਆਦਿ ਭਾਸ਼ਾਵਾਂ ਉਰਦੂ ਹਰਿਆਣਵੀ ਹਿੰਦੀ ਪੰਜਾਬੀ ਮਿਲਦੇ ਹਰਿਆਣਵੀ ਹਰਿਆਣੇ ਵਿੱਚ ਬੋਲੀ ਜਾਂਦੀ ਹੈ ਮਾਲਵਾੜੀ ਰਾਜਸਥਾਨ ਵਿੱਚ ਬੋਲੀ ਜਾਂਦੀ ਹੈ ਅਤੇ ਬਿਹਾਰੀ ਭਾਸ਼ਾ ਬਿਹਾਰ ਵਿੱਚ ਬੋਲੀ ਜਾਂਦੀ ਹੈ ਉਰਦੂ ਜਿੱਥੇ ਮੁਸਲਮਾਨ ਰਹਿੰਦੇ ਹਨ ਉੱਥੇ ਬੋਲੀ ਜਾਂਦੀ ਹੈ ਸਾਨੂੰ ਆਪਣੀ ਪੰਜਾਬੀ ਭਾਸ਼ਾ ਦੀ ਵਰਤੋਂ ਜ਼ਿਆਦਾ ਤੋਂ ਜ਼ਿਆਦਾ ਕਰਨੀ ਚਾਹੀਦੀ ਹੈ ਕਰਨੀ ਚਾਹੀਦੀ ਹੈ ਪਿੰਡਾਂ ਵਿੱਚ ਲੋਕ ਪੰਜਾਬੀ ਬੋਲਦੇ ਹਨ ਅਤੇ ਉਹਨਾਂ ਨੂੰ ਪੇਂਡੂ ਕਿਹਾ ਜਾਂਦਾ ਹੈ ਇਸ ਕਰਕੇ ਸਾਡੀ ਪੰਜਾਬੀ ਭਾਸ਼ਾ ਹਮੇਸ਼ਾਂ ਪੰਜਾਬੀ ਹੀ ਬੋਲਣੀ ਚਾਹੀਦੀ ਹੈ